ਸਤਿ ਸ਼੍ਰੀ ਅਕਾਲ ਭਾਰਤੀ ਲੇਖਕਾਂ ਨੇ ਸਾਡੇ ਸਭਿਆਚਾਰ ਨੂੰ ਅਜੇ ਤੱਕ ਸੰਯੋਗ ਰੱਖਿਆ ਹੋਇਆ ਹੈ ਤੇ ਸਾਨੂੰ ਅੱਜ ਵੀ ਪ੍ਰੇਰਨਾ ਦਿੰਦੇ ਹਨ ਹਾਲਾਂਕਿ ਆਧੁਨਿਕਤਾ ਦੇ ਕਾਰਨ ਸਾਡੀ ਅੱਜ ਕੱਲ ਦੀ ਨਵੀਂ ਪੀੜੀ ਸਾਡੇ ਭਾਰਤੀ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਪਰ ਇਹ ਲੇਖਕ ਹੀ ਹਨ ਜਿਨਾਂ ਨੇ ਆਪਣੀ ਕਲਾ ਦੇ ਨਾਲ ਸਾਡੇ ਸਭਿਆਚਾਰ ਨੂੰ ਸੰਜੋਅ ਕੇ ਰੱਖਿਆ ਹੋਇਆ ਹੈ ਇਹਨਾਂ ਦੀਆਂ ਲਿਖੀਆਂ ਹੋਈਆਂ ਸ਼ੈਲੀਆਂ ਲੋਕਾਂ ਤੇ ਬੜਾ ਹੀ ਪ੍ਰਭਾਵ ਪਾਦੀਆਂ ਹਨ ਤੇ ਲੋਕਾਂ ਨੂੰ ਬੜਾ ਹੀ ਰੁਝਾਰੂ ਰੱਖਦੀਆਂ ਹਨ ਇਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਨਾਟਕ ਸਾਨੂੰ ਬਹੁਤ ਹੀ ਜਿਆਦਾ ਪ੍ਰੇਰਨਾ ਦਿੰਦੇ ਹਨ ਤੇ ਲੋਕ ਇਹਨਾਂ ਤੋਂ ਬਹੁਤ ਹੀ ਜਿਆਦਾ ਸਿੱਖਿਆ ਲੈਂਦੇ ਹਨ ਤੇ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਵੀ ਕਰਦੇ ਹਨ ਇਹਨਾਂ ਦੀ ਲਿਖੀਆਂ ਹੋਈਆਂ ਕਵਿਤਾਵਾਂ ਤੇ ਨਾਟਕ ਸਾਨੂੰ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਬਾਰੇ ਜਾਣਕਾਰੀ ਦਿੰਦੇ ਹਨ ਜਿੰਨਾ ਜਿਆਦਾ ਭਾਰਤੀ ਲੇਖਕਾਂ ਨੇ ਸਾਡੇ ਸਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਹੋਰ ਕੋਈ ਨਹੀਂ ਕਰਦਾ ਸਾਡੀ ਭਾਰਤੀ ਲੇਖਕ ਹੀ ਸਾਡੇ ਸਭਿਆਚਾਰ ਨੂੰ ਜਿੰਨਾਂ ਵਧੀਆ ਤਰੀਕੇ ਨਾਲ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕਾਂ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਹੋਰ ਕੋਈ ਨਹੀਂ ਕਰ ਸਕਦਾ